ਔਨਲਾਈਨ ਅਤੇ ਔਫਲਾਈਨ ਸੁਵਿਧਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਵਿੱਚ ਜਿਹੜੀ ਜ਼ਿਆਦਾ ਵਧੀਆ ਲੱਗਦੀ ਹਰੇਕ ਦੇ ਵਿਸ਼ੇ ਆਪਣੇ ਫਾਇਦੇ ਹੈ ਵੈਸੇ ਪਰ ਔਨਲਾਈਨ ਜਿਹੜੀਆਂ ਚੀਜ਼ਾਂ ਔਨਲਾਈਨ ਸੁਵਿਧਾਵਾਂ ਉਹਨਾਂ ਦੇ ਫਾਇਦੇ ਜ਼ਿਆਦਾ ਕਿਉਂਕਿ ਔਨਲਾਈਨ ਚੀਜ਼ਾਂ ਨੂੰ ਅਸੀਂ ਕਿਤੇ ਵੀ ਜਾ ਕੇ ਕਿਤੇ ਵੀ ਉਹਨੂੰ ਐਕਸੈਸ ਕਰ ਸਕਦੇ ਠੀਕ ਆ ਕਿਤੇ ਵੀ ਜਾ ਕੇ ਉਹਨੂੰ ਕਿਸ ਕੋਈ ਟਾਈਮ ਦੀ ਬੰਦਿਸ਼ ਨਹੀਂ ਹੈ ਕੋਈ ਸਮੇਂ ਦੀ ਕੋਈ ਸਥਾਨ ਦੀ ਬੰਦਿਸ਼ ਨਹੀਂ ਹੈ ਤੁਹਾਨੂੰ ਬਸ ਇੱਕ ਇੰਟਰਨੈਟ ਕਨੈਕਸ਼ਨ ਚਾਹੀਦਾ ਅਤੇ ਇੱਕ ਵਧੀਆ ਸਮਾਰਟਫੋਨ ਜਾਂ ਵੱਧ ਤੋਂ ਵੱਧ ਬੜਾ ਕੰਪਿਊਟਰ ਉਹਦੀ ਵਰਤੋਂ ਨਾਲ ਤੁਸੀਂ ਔਨਲਾਈਨ ਸੁਵਿਧਾਵਾਂ ਜਿੱਦਾਂ ਕਿ ਆਧਾਰ ਕਾਰਡ ਅਸੀਂ ਬਣਾਉਣਾ ਜਾਂ ਪੈਨ ਕਾਰਡ ਬਣਵਾਉਣਾ ਅਸੀਂ ਆਪਣੇ ਆਪ ਹੀ ਘਰ ਹੀ ਬੈਠੇ ਹੀ ਸੁਵਿਧਾਵਾਂ ਔਨਲਾਈਨ ਕਰ ਸਕਦੇ ਪਾਸਪੋਰਟ ਬਣਵਾਉਣਾ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਸਾਡੀ ਜਿਹੜੀ ਅਸੀਂ ਕਿਸੇ ਨੂੰ ਔਫਲਾਈਨ ਜਾ ਕੇ ਅਸੀਂ ਕਿਤੇ ਜਾ ਕੇ ਆਪਣੇ ਰਿਸੋਰਸ ਖਤਮ ਕਰਨੇ ਉਹ ਤੋਂ ਉਹ ਤੋਂ ਚੰਗਾ ਇਹ ਆ ਕਿ ਅਸੀਂ ਔਨਲਾਈਨ ਬਹਿ ਕੇ ਘਰ ਬਹਿ ਕੇ ਕੰਮ ਕਰ ਲਈਏ ਅਤੇ ਉਸ ਨਾਲ ਸਾਡੀ ਪੈਟਰੋਲ ਖਰਚਾ ਜਾਂ ਕਿਤੇ ਆਉਣ ਜਾਣ ਦਾ ਖਰਚਾ ਵੀ ਬਚਦਾ ਪ ਅਤੇ ਇਸ ਤਰ੍ਹਾਂ ਹੀ ਜਿੱਦਾਂ ਔਨਲਾਈਨ ਸੁਵਿਧਾਵਾਂ ਦੇ ਵਿੱਚ ਪਾਸਪੋਰਟ ਅਪਲਾਈ ਕਰਨਾ ਹੁੰਦਾ ਜਿੱਦਾਂ ਅਸੀਂ ਤਾਂ ਬਹੁਤ ਸੌਖੇ ਤਰੀਕੇ ਨਾਲ ਬੜੇ ਹੀ ਸਿੰਪਲ ਸਾਈਟ ਹੁੰਦੀ ਉਹਦੀ ਬੜੇ ਵਧੀਆ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਕਿਤੇ ਵੀ ਸਮੇਂ ਦੀ ਕੋਈ ਬੰਦਿਸ਼ ਨਹੀਂ ਪਹਿਲਾ ਪੁਆਇੰਟ ਦੂਜਾ ਸ ਦੂਜਾ ਪੁਆਇੰਟ ਇਹ ਆ ਕਿ ਸਾਨ ਦੀ ਕੋਈ ਬੰਦਿਸ਼ ਨਹੀਂ ਸਿਰਫ ਇੱਕ ਛੋਟਾ ਜਿਹਾ ਇੰਟਰਨੈਟ ਕਨੈਕਸ਼ਨ ਚਾਹੀਦਾ ਜੋ ਆਮ ਅੱਜ ਕੱਲ੍ਹ ਹਰੇਕ ਸਮਾਰਟਫੋਨ ਦੇ ਵਿੱਚ ਹੈਗਾ ਹੀ ਆ ਉੱਤੇ ਬੈ ਬੈਠੇ ਅਸੀਂ ਡੈਸਕਟੋਪ ਸਾਈਟ ਫੋਨ ਦੇ ਵਿੱਚ ਵੀ ਖੁੱਲ੍ਹ ਜਾਂਦੀ ਮੋਬਾਈਲ ਸਾਈਟ ਤੋਂ ਵੀ ਕਰ ਸਕਦੇ ਹਾਂ ਜਿੱਦਾਂ ਠੀਕ ਲੱਗੇ ਅਸੀਂ ਉੱਦਾਂ ਆਪਣੀ ਐਕਸੈਸ ਕਰ ਸਕਦੇ ਹਾਂ ਕਿਸੇ ਨੂੰ ਕੋਈ ਬੰਦਾ ਲੱਭਣ ਦੀ ਕੋਈ ਲੋੜ ਤਾਂ ਨਹੀਂ ਕੋਈ ਅਫਸਰ ਕੋਲ ਜਾਣ ਦੀ ਲੋੜ ਨਹੀਂ ਕਿ ਸਮਾਂ ਕਿਤੇ ਦਫਤਰ ਜਾਣ ਦੀ ਲੋੜ ਨਹੀਂ ਠੀਕ ਹੈ ਨਾ ਇਹ ਉਹਦਾ ਫਾਇਦਾ ਹੁੰਦਾ ਅਤੇ ਫੀਸ ਵੀ ਉਹ ਔਨਲਾਈਨ ਦੇ ਹੋ ਜਾਣੀ ਠੀਕ ਹੈ ਨਾ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਹੁੰਦੀਆਂ ਜਿਸ ਵਿਸ਼ੇ ਦੀ ਗੱਲ ਕਰਾਂਗੇ